ਬਰਤਨ ਧੋਣ ਦੀ ਪ੍ਰਕ੍ਰਿਆ ਜੂਠੇ ਬਰਤਨਾਂ ਨੂੰ ਇਕੱਠਾ ਕਰਨਾ ਖਾਣ ਪੀਣ ਦੇ ਬਚੇ ਹੋਏ ਟੁਕਰੇ ਟਾਏ ਜਾਂਦੇ ਹਨ ਬਰਤਨਾਂ ਨੂੰ ਉਹਨਾਂ ਦੀ ਕਿਸਮ ਮੁਤਾਬਕ ਵੱਖ ਵੱਖ ਕੀਤੀਆਂ ਜਾਂਦੀਆਂ ਹਨ ਕਾਂਚ ਧਾਤੂ ਪਲਾਸਟਿਕ ਆਦਿ ਬਰਤਨ ਨੂੰ ਭਿਗੋਣਾ ਜੇਕਰ ਬਰਤਨ 'ਤੇ ਜ਼ਿਆਦਾ ਮੈਲ ਜਾਂ ਸੁੱਕਾ ਹੋਇਆ ਖਾਣਾ ਚਿਪਕਿਆ ਹੋਇਆ ਹੈ ਤਾਂ ਉਹਨਾਂ ਨੂੰ ਕੁਝ ਸਮਾਂ ਲਈ ਗਰਮ ਪਾਣੀ 'ਚੋ ਭਿਗੋ ਕੇ ਰੱਖਿਆ ਜਾਂਦਾ ਹੈ ਸਾਬਣ ਜਾਂ ਡਿਟਰਜੈਂਟ ਨਾਲ ਮਲਣਾ ਸਾਫ ਕਰਨ ਲਈ ਹੱਥ ਨਾਲ ਜਾਂ ਸਕ੍ਰਬਰ ਦੀ ਵਰਤੋਂ ਕਰਦੇ ਹਨ ਨੋਰਮਲ ਮੈਲ ਵਾਲੇ ਬਰਤਨ ਲਈ ਹਲਕੇ ਸਾਬਣ ਦੀ ਵਰਤੋਂ ਕੀਤੀ ਜਾਂਦੀ ਹੈ ਤੇਲ ਵਾਲੇ ਬਰਤਨ ਸਾਫ ਕਰਨਾ ਗਰਮ ਪਾਣੀ ਗਰਮ ਪਾਣੀ ਤੇਲ ਨੂੰ ਢਿੱਲਾ ਕਰਕੇ ਸਾਫ ਕਰਨ ਕਰਨਾ ਆਸਾਨ ਬਣਾਉਂਦਾ ਹੈ ਵਨਿਗਰ ਜਾਂ ਸੋਡਾ ਕੁਛ ਲੋਗ ਭਾਰੀ ਚਿਕਨਾਹਟ ਹਟਾਉਣ ਲਈ ਵਨਿਗਰ ਜਾਂ ਬੇਕਿੰਗ ਸੋਡਾ ਦੀ ਵਰਤੋਂ ਕਰਦੇ ਹਨ ਪਾਣੀ ਨਾਲ ਧੋਣਾ ਸਾਰੇ ਬਰਤਨ ਨੂੰ ਚੰਗੇ ਤਰ੍ਹਾਂ ਸੁੱਥੇ ਪਾਣੀ ਨਾਲ ਧੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਸਾਬਣ ਜਾਂ ਡਿਟਰਜੈਂਟ